ਇਸ ਵਿੱਚ ਕੋਈ ਸ਼ੱਕ ਨਹੀਂ ਕਿ ਤੈਕਨੋਲੋਜੀ ਵਿੱਚ ਤਰੱਕੀ ਨੇ ਸਾਡੀ ਜ਼ਿੰਦਗੀ ਨੂੰ ਆਸਾਨ ਬਣਾ ਦਿੱਤਾ ਹੈ ਮੈਂ ਹੁਣ ਦੱਸਣ ਜਾ ਰਿਹਾ ਹਾਂ ਕਿ ਇਹ ਕਿਵੇਂ ਕੀਤਾ ਸਭ ਤੋਂ ਪਹਿਲਾਂ ਟੈਕਨੋਲੋਜੀ ਨੇ ਸਾਨੂੰ ਸਾਡੀ ਉਂਗਲੀਆਂ 'ਤੇ ਜਾਣਕਾਰੀ ਅਤੇ ਮਨੋਰੰਜਨ ਦੇ ਭੰਡਾਰ ਪੁੱਛ ਪ੍ਰਦਾਨ ਕੀਤੀ ਹੈ ਅਸੀਂ ਕੁਛ ਵੀ ਸਿੱਖ ਸਕਦੇ ਹਾਂ ਜੋ ਅਸੀਂ ਚਾਹੁੰਦੇ ਹਾਂ ਜੋ ਵੀ ਅਸੀਂ ਚਾਹੁੰਦੇ ਹਾਂ ਦੇਖ ਸਕਦੇ ਹਾਂ ਅਤੇ ਕਿਸੇ ਵੀ ਵਿਅਕਤੀ ਨਾਲ ਗੱਲਬਾਤ ਕਰ ਸਕਦੇ ਹਾਂ ਜਿਸ ਦੀ ਅਸੀਂ ਪਰਵਾਹ ਵੀ ਨੀ ਕਰਦੇ ਕਿਸੇ ਵੀ ਸਮੇਂ ਅਤੇ ਕਿਤੇ ਵੀ ਦੂਜਾ ਟੈਕਨੋਲੋਜੀ ਨੇ ਸਾਡੀ ਸਿਹਤ ਅਤੇ ਤੰਦਰੁਸਤੀ ਵਿੱਚ ਸੁਧਾਰ ਕੀਤਾ ਹੈ ਸਾਡੇ ਕੋਲ ਬਿਹਤਰ ਮੈਡੀਕਲ ਉਪਕਰਨ ਇਲਾਜ ਅਤੇ ਟੀਕੇ ਹਨ ਜੋ ਬਿਮਾਰੀਆਂ ਨੂੰ ਰੋਕ ਸਕਦੇ ਹਨ ਅਤੇ ਠੀਕ ਵੀ ਕਰ ਸਕਦੇ ਹਨ ਸਾਡੇ ਕੋਲ ਫਿਟਨੈਸ ਟਰੈਕਰ ਸਮਾਰਟ ਵਾਚਿਸ ਅਤੇ ਐਪਸ ਹਨ ਜੋ ਸਾਡੇ ਮਹੱਤਵਪੂਰਨ ਸੰਕੇਤਾਂ ਦੀ ਨਿਗਰਾਨੀ ਕਰ ਸਕਦੇ ਹਨ ਅਤੇ ਫਿਟ ਅਤੇ ਸਿਹਤਮੰਦ ਰਹਿਣ ਵਿੱਚ ਸਾਡੀ ਮਦਦ ਵੀ ਕਰ ਸਕਦੇ ਹਨ ਤੀਜਾ ਟੈਕਨੋਲੋਜੀ ਨੇ ਸਾਡੀ ਉਤਪਾਦਕਤਾ ਅਤੇ ਰਚਮ ਰਚਨਾਤਮਕਤਾ ਨੂੰ ਵਧਾਇਆ ਵੀ ਹੈ ਸਾਡੇ ਕੋਲ ਸ਼ਕਤੀਸਾਲੀ ਟੂਲ ਸੋਫਟਵੇਅਰ ਅਤੇ ਪਲੇਟਫੋਮ ਹਨ ਜੋ ਸਾਨੂੰ ਚੁਸਤ ਤੇਜ਼ ਅਤੇ ਬਿਹਤਰ ਕੰਮ ਕਰਨ ਵਿੱਚ ਮਦਦ ਵੀ ਕਰਦੇ ਹਨ ਅਸੀਂ ਦੁਨੀਆਂ ਭਰ ਦੇ ਲੋਕਾਂ ਨਾਲ ਸਹਿਯੋਗ ਕਰਦੇ ਹਨ ਆਪਣੇ ਵਿਚਾਰਾਂ ਨਵੀਤਾਵਾਂ ਨੂੰ ਸਾਂਝਾ ਕਰਦੇ ਹਨ ਅਤੇ ਸ਼ਾਨ ਸ਼ਾਨਦਾਰ ਚੀਜ਼ਾਂ ਵੀ ਬਣਾਉਂਦੇ ਹਨ ਜੋ ਪਹਿਲਾਂ ਸੰਭਵ ਨਹੀਂ ਹੋ ਸਕਦਾ ਸੀ ਪਰ ਟੈਕਨੋਲੋਜੀ ਵਿੱਚ ਤਰੱਕੀ ਨੇ ਇਹ ਸਭ ਨੂੰ ਸੰਭਵ ਬਣਾ ਦਿੱਤਾ ਹੈ ਧੰਨਵਾਦ